ਹੈਲੋ ਸ਼ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂ ਮੈਡਮ ਜੀ ਮੈਂ ਸੁਣਿਆ ਸੀ ਤੁਹਾਡੇ ਕਲੱਬ ਵਿੱਚ ਬਹੁਤ ਉਹ ਦੀ ਵਧੀਆ ਐਕਟੀਵਿਟੀਆਂ ਹੈਗੀਆਂ ਜੀ ਹਾਂਜੀ ਅਤੇ ਮੈਂ ਚਾਹੁੰਦਾ ਕਿ ਮੇਰਾ ਬੱਚਾ ਵੀ ਤੁਹਾਡੇ ਉੱਥੇ ਆਵੇ ਅਤੇ ਕੋਈ ਐਸਾ ਡਾਂਸ ਕੋਈ ਸਵਿਮਿੰਗ ਵਗੈਰਾ ਸਿੱਖੇ ਕੋਈ ਵਗੈਰਾ ਸੰਗੀਤ ਡਰਾਇੰਗ ਵਗੈਰਾ ਸਿੱਖੇ ਅਤੇ ਮੈਂ ਪੁੱਛਣਾ ਚਾਹੁੰਦਾ ਸੀ ਕਿ ਵੀ ਮਤਲਬ ਇੱਕ ਹਫ਼ਤੇ ਦੀ ਕਿੰਨੀ ਕੁ ਫੀਸ ਹੈਗੀ ਆ ਮੈਡਮ ਜੀ ਹਾਂ ਪੰਜ ਸੌ ਰੁਪਿਆ ਠੀ ਠੀਕ ਆ ਜੀ ਅਤੇ ਮੈਂ ਚਾਹੁੰਦਾ ਕਿ ਮੇਰੇ ਬੱਚੇ ਨੂੰ ਮਤਲਬ ਬੜੀ ਹੀ ਸੂਝ ਬੂਝ ਨਾਲ ਸਿਖਾਇਆ ਜਾਵੇ ਇਹਨੂੰ ਜਿੱਦਾਂ ਮਤਲਬ ਡਰਾਇੰਗ ਬਣਾਉਣਾ ਹੋਰ ਵੀ ਮਤਲਬ ਸਵੀਮਿੰਗ ਵਗੈਰਾ ਸੰਗੀਤ ਵਗੈਰਾ ਸਿਖਾਇਆ ਜਾਵੇ ਠੀਕ ਹੈ ਨੀ ਕਿਉਂਕਿ ਇਸ ਵਕਤ ਤਾਂ ਗਰਮੀਆਂ ਦਾ ਮੌਸਮ ਹੈ ਬੱਚਿਆਂ ਨੂੰ ਵੀ ਸਕੂਲ ਦੇ ਵਿੱਚ ਛੁੱਟੀਆਂ ਪਈਆਂ ਠੀਕ ਹੈ ਨਾ ਤੇ ਬੱਚੇ ਇੱਦਾਂ ਵੀ ਬੜੇ ਘਰ ਸ਼ੈਤਾਨ ਸ਼ੈਤਾਨ ਪੂਰਾ ਬਹੁਤ ਕਰਦੇ ਨੇ ਬੱਚੇ ਦਾ ਮਤਲਬ ਖ਼ਰਾਬ ਹੋ ਜਾਂਦੇ ਘਰ ਵਿਹਲੇ ਬਹਿ ਕੇ ਬੱਚੇ ਸ਼ੈਤਾਨ ਹੋ ਜਾਂਦੇ ਬਹੁਤ ਕਿ ਮੈਂ ਚਾਹੁੰਦਾ ਵੀ ਜਿੱਦਾਂ ਸਕੂਲ 'ਚ ਛੁੱਟੀਆਂ ਜਿੱਦਾਂ ਬੱਚੇ ਤੁਹਾਡੇ ਕਲੱਬ ਵਿੱਚ ਆਉਣ ਤਾਂ ਕੁਛ ਨਾ ਕੁਛ ਸਿੱਖਣ ਨੂੰ ਉਹ ਪਾਣਗੇ ਠੀਕ ਹੈ ਨਹੀਂ ਅਤੇ ਮੈਂ ਚਾਹੁੰਦਾ ਕਿ ਮੇਰੇ ਬੱਚੇ ਨੂੰ ਬਹੁਤ ਹੀ ਵਧੀਆ ਮਤਲਬ ਸੰਗੀਤ ਵਗੈਰਾ ਸਿਖਾਇਆ ਜਾਵੇ ਇਹਨੂੰ ਹੋਰ ਵੀ ਜਿੱਦਾਂ ਡਰੈਂਗ ਵਗੈਰਾ ਹੋ ਗਈ ਹਾਂ ਹਾਂ ਅਤੇ ਮੇਰੇ ਬੱਚੇ ਦਾ ਮਤਲਬ ਧਿਆਨ ਰੱਖਣਾ ਜੀ ਅਤੇ ਇਹ ਇਹ ਕਿੰਨੀ ਫੀਸ ਦੱਸੀ ਮੈਡਮ ਜੀ ਤੁਸੀਂ ਇੱਕ ਹਫ਼ਤੇ ਦੀ ਇਹਦੀ ਅਤੇ ਦੋ ਹਫ਼ਤੇ ਦੀ ਕਿੰਨੀ ਹੋ ਜਾਵੇਗੀ ਮੈਡਮ ਜੀ ਫਿਰ ਹਾਂ ਹਜ਼ਾਰ ਰੁਪਈਆ ਅਤੇ ਇਹਦੇ 'ਚ ਮੈਡਮ ਲੈਸ ਨਹੀਂ ਹੋਣਗੇ ਪੈਸੇ ਕੋਈ ਹਾਂ ਠੀਕ ਹੈ ਮੈਡਮ ਜੀ ਅਤੇ ਮੈਂ ਆਪਣੇ ਬੱਚੇ ਨੂੰ ਕਦੋਂ ਤੋਂ ਭੇਜਾ ਜੀ ਤੁਹਾਡੇ ਕਲੱਬ 'ਚ ਨਹੀਂ ਉਹਦੇ ਮਤਲਬ ਫਾਰਮ ਫੁਰਮ ਵੀ ਭਰਨਾ ਨਾ ਬੱਚੇ ਦਾ ਐਡਮਿਸ਼ਨ ਵਗੈਰਾ ਹਾਂਜੀ ਹਾਂਜੀ ਹਾਂ ਠੀਕ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਇੱਦਾਂ ਕਰਦੇ ਹਾਂ ਮੈਡਮ ਜੀ ਮੈਨੂੰ ਇਹਦਾ ਫਾਰਮ ਤੁਸੀਂ ਵਟਸਐਪ 'ਤੇ ਸੈਂਡ ਕਰ ਦਿਓ ਮੈਂ ਬੱਚੇ ਦਾ ਫਾਰਮ ਫੂਰਮ ਭਰ ਦਾਂਗਾ ਠੀਕ ਹੈ ਨਾ ਜੀ ਅਤੇ ਹੋ ਸਕੇ ਮੈਂ ਬੱਚਿਆਂ ਨੂੰ ਕੱਲ੍ਹ ਤੋਂ ਹੀ ਬੱਚੇ ਨੂੰ ਤੁਹਾਡੇ ਸਕੂਲ ਦੇ ਵਿੱਚ ਭੇਜਦਾ ਮਤਲਬ ਤੁਹਾਡੀ ਕਲਾਸ ਦੇ ਵਿੱਚ ਭੇਜ ਦਾਂਗਾ ਮੈਡਮ ਜੀ ਅਤੇ ਠੀਕ ਹੈ ਮਿਹਰਬਾਨੀ ਮੈਡਮ ਜੀ ਧੰਨਵਾਦ ਜੀ ਓਕੇ ਮੈਡਮ ਜੀ